ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪਕ ਵਾਸੂ ਆ ਅਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਅਤੇ ਮੇਰੇ ਦੋਸਤ ਸ਼ਿਮਲਾ ਜਾਣ ਦੀ ਕੋਈ ਯੋਜਨਾ ਬਣਾ ਰਹੇ ਸੀ ਅਤੇ ਉੱਥੇ ਜਾਣ ਵਾਸਤੇ ਸਾਨੂੰ ਇੱਕ ਛੋਟੀ ਗੱਡੀ ਕਿਰਾਏ 'ਤੇ ਚਾਹੀਦੀ ਹੈ ਸਾਡਾ ਇੱਕ ਹਫਤੇ ਦਾ ਟੂਰ ਆ ਉੱਥੇ ਜਾਣ ਦਾ ਇੱਕ ਹਫਤਾ ਅਸੀਂ ਉੱਥੇ ਰਹਿ ਕੇ ਉੱਥੇ ਘੁੰਮਣਾ ਫਿਰਨਾ ਜੀ ਸਾਨੂੰ ਪ੍ਰਤੀ ਕਿਲੋਮੀਟਰ ਕਿਲੋਮੀਟਰ ਦੇ ਕਿੰਨੇ ਇੱਕ ਕਿਲੋਮੀਟਰ ਦੇ ਹਿਸਾਬ ਨਾਲ ਦੱਸੋ ਕਿੰਨੇ ਪੈਸੇ ਪੈਣਗੇ ਪ੍ਰਤੀ ਕਿਲੋਮੀਟਰ ਸਾਨੂੰ ਕਿੰਨੇ ਪੈਸੇ ਦੇਣੇ ਪੈਣਗੇ ਕਿਰਾਏ ਦੇ ਗੱਡੀ ਅਸੀਂ ਆਪ ਚਲਾ ਲਵਾਂਗੇ ਤੁਹਾਨੂੰ ਜਿਹੜੇ ਕਾਗਜਾਤ ਜੋ ਵੀ ਚਾਹੀਦਾ ਆਪਾਂ ਦੇਣ ਨੂੰ ਤਿਆਰ ਹਾਂ ਜੀ ਸ਼ਿਮਲੇ ਜਾਣਾ ਲਾਗੇ ਸ਼ਾਗੇ ਜਿਹੜੀ ਹੋਰ ਉੱਥੇ ਹੈਗੀ ਆ ਘੁੰਮਣ ਵਾਲੀਆਂ ਚ ਜਗ੍ਹਾ ਉੱਥੇ ਘੁੰਮ ਕੇ ਆਉਣਾ ਆਉਣਾ ਆਪਾਂ ਇੱਕ ਹਫਤਾ ਰਹਿਣਾ ਵਾ ਜਿੰਨਾ ਸਾਨੂੰ ਛੋਟੀ ਗੱਡੀ ਦਾ ਤੁਸੀਂ ਸਾਰਾ ਦੱਸ ਦਿਓ ਕਿ ਕੀ ਹੈਗਾ ਇੰਤਜ਼ਾਮ ਕਿੰਨੇ 'ਚ ਗੱਡੀ ਪੈਣੀ ਆ ਸਾਨੂੰ ਉਹਨੂੰ ਲੈਣ ਵਾਸਤੇ ਕਿਰਾਏ 'ਤੇ ਲੈਣ ਵਾਸਤੇ ਸਾਨੂੰ ਕਿਹੜੇ ਕਿਹੜੇ ਕਾਗਜਾਤ ਤੁਹਾਨੂੰ ਦੇਣੇ ਪੈਣੇ ਆ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਨੂੰ ਦੱਸ ਦਿਓ ਅਸੀਂ ਚਾਰ ਜਣੇ ਆ ਇੱਥੋਂ ਜਾਣ ਵਾਸਤੇ ਅਤੇ ਜੋ ਵੀ ਖਰਚਾ ਆਏਗਾ ਉਹ ਤੁਹਾਨੂੰ ਆਪਾਂ ਦੇਣ ਨੂੰ ਜਿੱਦਾਂ ਵੀ ਆ ਜੇ ਕੋਈ ਨੁਕਸਾਨ ਹੁੰਦਾ ਗੱਡੀ ਦਾ ਸਾਰੀ ਟੁੱਟ ਭੰਨ ਦਾ ਜ਼ਿੰਮੇਵਾਰ ਅਸੀਂ ਹੋਵਾਂਗੇ ਇੱਕ ਹਫਤੇ ਵਾਸਤੇ ਸਾਨੂੰ ਦੱਸ ਦਿਓ ਕਿ ਗੱਡੀ ਕਿੰਨੇ ਦੀ ਪਏਗੀ ਜੀ ਧੰਨਵਾਦ ਜੀ